ਮੈਂ ਚਿੱਤਰਕਾਰੀ ਦੀ ਕਲਾਸ ਲਾਈ ਹੈ ਡਰਾਇੰਗ ਦੇ ਵਿੱਚ ਹੱਥ ਬਹੁਤ ਵਧੀਆ ਅਤੇ ਉੱਥੇ ਜਿਹੜੇ ਸਾਡੇ ਸਰ ਸੀਗੇ ਸਰਦਾਰ ਬਲਵੰਤ ਸਿੰਘ ਜੀ ਬਹੁਤ ਵਧੀਆ ਅਤੇ ਬਹੁਤ ਜ਼ਿਆਦਾ ਵਧੀਆ ਸਰਲ ਅਤੇ ਸਾਫ਼ ਸੁਥਰੇ ਤਰੀਕੇ ਦੇ ਨਾਲ ਉਹ ਚੀਜ਼ ਨੂੰ ਸਮਝਾਉਂਦੇ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਉਹ ਬਹੁਤ ਵਧੀਆ ਪਿਆਰ ਦੇ ਨਾਲ ਦੱਸਦੇ ਹੁੰਦੇ ਸੀਗੇ ਕਿਸੇ ਵੀ ਚੀਜ਼ ਨੂੰ ਕਿੱਦਾਂ ਬਣਾਉਣਾ ਉਹਦੇ 'ਤੇ ਕਿੱਦਾਂ ਕੰਮ ਕਰਨਾ ਹੈ ਕੀ ਸ਼ੇਡ ਕਰਨੀ ਹੈ ਕਿੱਦਾਂ ਕਰਨੀ ਹੈ ਸਾਰਾ ਕੁਛ ਉਹ ਪਿਆਰ ਦੇ ਨਾਲ ਸਮਝਾਉਂਦੇ ਹੁੰਦੇ ਸੀਗੇ ਕਦੇ ਜੇ ਬੱਚੇ ਨੂੰ ਨਹੀਂ ਵੀ ਸਮਝ ਲੱਗਦੀ ਸੀ ਉਹ ਫਿਰ ਦੁਬਾਰਾ ਉਸਨੂੰ ਆਪਣੇ ਕੋਲ ਬੁਲਾ ਕੇ ਉਸਦੇ ਹੱਥਾਂ ਤੋਂ ਬਣਵਾਉਂਦੇ ਹੁੰਦੇ ਸੀ ਵੀ ਹਾਂ ਤੁਸੀਂ ਇੱਦਾਂ ਬਣਾਓ ਤਾਂ ਤੁਸੀਂ ਆਪਣੇ ਆਪ ਇੰਡੀਪੈਂਡੈਂਟ ਹੋ ਕੇ ਉਹ ਚੀਜ਼ ਨੂੰ ਸਿੱਖ ਸਕਦੇ ਹੋ ਕਰ ਸਕਦੇ ਹੋ ਜਿਹਦੇ ਕਰਕੇ ਤੁਹਾਨੂੰ ਅੱਗੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਉਹਨਾਂ ਨੇ ਹਰੇਕ ਬੱਚੇ ਨੂੰ ਆਪਣੇ ਹੱਥਾਂ ਦੇ ਨਾਲ ਇਕੱਲੀ ਇਕੱਲੀ ਚੀਜ਼ ਤੋਂ ਸਿਖਾਇਆ ਹੈ ਪੜ੍ਹਾਇਆ ਹੈ ਅਤੇ ਚੰਗਾ ਬਣਾਇਆ ਹੈ